ਮੇਰਾ ਮਾਰਕੀਟ ਦਾ ਬਿਜ਼ਨਸ ਹੈ ਜਿਸ ਕਾਰਨ ਮੈਨੂੰ ਘਰ ਤੋਂ ਜ਼ਿਆਦਾਤਰ ਬਾਹਰ ਹੀ ਰਹਿਣਾ ਪੈਂਦਾ ਹੈ ਇਸ ਕਾਰਨ ਮੈਨੂੰ ਹੋਟਲਾਂ ਅਤੇ ਢਾਬਿਆਂ ਵਿੱਚ ਜਾਣ ਦਾ ਮੌਕਾ ਮਿਲ ਜਾਂਦਾ ਹੈ ਜਿਸ ਦੇ ਵਿੱਚ ਮੈਂ ਜ਼ਿਆਦਾਤਰ ਪੰਜਾਬ ਦੇ ਵਿੱਚ ਪੰਜਾਬੀ ਖਾਣੇ ਨੂੰ ਵੀ ਪਸੰਦ ਕਰਦਾ ਹਾਂ ਪੰਜਾਬ ਦੇ ਵਿੱਚ ਰਹਿੰਦੇ ਹੋਇਆਂ ਮੈਂ ਢਾਬਿਆਂ ਉੱਪਰ ਮੱਖਣੀ ਪਰੋ ਸਿੰਪਲ ਪਰੌਂਠਾ ਔਰ ਪਨੀਰ ਵਗੈਰਾ ਪਸੰਦ ਕੀਤਾ ਜਾ ਕਰਦਾ ਔਰ ਖਾਂਦਾ ਹਾਂ ਇਸ ਤਰ੍ਹਾਂ ਦਿੱਲੀ ਜਾਂ ਹੋਰ ਕਿਸੇ ਸਿਟੀ ਵਿੱਚ ਜਾਣ 'ਤੇ ਫਾਸਟ ਫੂਡ ਜਿਸ ਵਿੱਚ ਬਰਗਰ ਪੀਜ਼ਾ ਆਦਿ ਮੇਰੀ ਪਸੰਦ ਦੇ ਨੇ ਜਿਨ੍ਹਾਂ ਨੂੰ ਖਾ ਕੇ ਕੁਝ ਸਕੂਨ ਮਿਲਦਾ ਹੈ ਅਤੇ ਆਪਣੇ ਸਫ਼ਰ ਨੂੰ ਆਸਾਨ ਵੀ ਬਣਾਇਆ ਜਾਂਦਾ ਹੈ ਔਰ ਜ਼ਰੂਰਤ ਨੂੰ ਪੂਰਾ ਕਰ ਲਿਆ ਜਾਂਦਾ ਹੈ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਵਿੱਚ ਘੁੰਮਣ ਫਿਰਨ ਦਾ ਮੌਕਾ ਅਤੇ ਢਾਬੇ ਜਾਂ ਮਤਲਬ ਹੋਟਲਾਂ ਵਿੱਚ ਆਏ ਹੋਏ ਲੋਕਾਂ ਦੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੋਂ ਆਏ ਹੋਏ ਲੋਕਾਂ ਦੇ ਭਾਸ਼ਾ ਔਰ ਉਹਨਾਂ ਦਾ ਰਹਿਣ ਸਹਿਣ ਦੇ ਬਾਰੇ ਪਤਾ ਚੱਲਦਾ ਹੈ